ਯੋਗ ਦਾ ਅਭਿਆਸ ਕਰਨ ਤੋਂ ਬੇਸ਼ੁਮਾਰ ਲਾਭ ਮਿਲਦੇ ਹਨ ਜੋ ਸਰੀਰਿਕ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਨੂੰ ਸੁਧਾਰਦੇ ਹਨ ਯੋਗ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ ਜੋ ਮਨੁੱਖ ਦੇ ਮਨ ਸਰੀਰ ਅਤੇ ਆਤਮਾ ਨੂੰ ਸਹੀ ਤਰੀਕੇ ਨਾਲ ਸੰਤੁਲਿਤ ਕਰਦੀ ਹੈ ਇਹ ਸਾਨੂੰ ਸਰੀਰਿਕ ਤੰਦਰੁਸਤੀ ਮਨ ਦੀ ਸ਼ਾਂਤੀ ਤਨਾਅ ਮੁਕਤੀ ਅਤੇ ਆਤਮਿਕ ਉੱਨਤੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਸਰੀਰਿਕ ਲਾਭ ਯੋਗ ਦੀ ਨਿਰੰਤਰ ਅਭਿਆਸ ਕਰਨ ਨਾਲ ਸਰੀਰ ਲਚਕਦਾਰ ਅਤੇ ਤੰਦਰੁਸਤ ਬਣਦਾ ਹੈ ਇਹ ਮਾਸਪੇਸ਼ੀਆਂ ਦੀ ਸ਼ਕਤੀ ਸੰਯੁਕਤਾ ਦੀ ਲਚਕਤਾ ਅਤੇ ਰਕਤ ਸੰਚਾਰ ਨੂੰ ਸੁਧਾਰਦਾ ਹੈ ਕੁਝ ਮਹੱਤਵਪੂਰਨ ਲਾਭ ਇਹ ਹਨ ਯੋਗ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਜਿਸ ਨਾਲ ਸਰੀਰ ਦੀ ਸੰਤੁਲਨ ਵੱਧਦੀ ਹੈ ਯੋਗ ਦੇ ਵੱਖ ਵੱਖ ਆਸਨ ਸਰੀਰ ਨੂੰ ਲਚਕਦਾਰ ਬਣਾਉਂਦੇ ਹਨ ਜਿਸ ਨਾਲ ਹੱਡੀਆਂ ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਢਿੱਲਾਪਣ ਨਹੀਂ ਆਉਂਦਾ ਯੋਗ ਦੀਆਂ ਕੁਝ ਵਿਧੀਆਂ ਜਿਵੇਂ ਕਿ ਪ੍ਰਾਣਾਯਾਮ ਅਤੇ ਧਿਆਨ ਦਿਲ ਦੀ ਧੜਕਣ ਨੂੰ ਨਿਯਮਿਤ ਰੱਖਣ ਵਿੱਚ ਮਦਦ ਕਰਦੀਆਂ ਹਨ ਯੋਗ ਦੀ ਨਿਯਮਿਤ ਅਭਿਆਸ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਡਾਇਬਟੀਜ ਹਾਈ ਬਲੱਡ ਪ੍ਰੈਸ਼ਰ ਮਾਈਗਰੇਨ ਅਤੇ ਪਾਚਨ ਤੰਤਰ ਦੀਆਂ ਸਮੱਸਿਆਵਾਂ ਤੋਂ ਬਚਾਅ ਆਉਂਦਾ ਹੈ ਯੋਗ ਸਿਰਫ ਸਰੀਰ ਲਈ ਨੇ ਹੀ ਨਹੀਂ ਸਗੋਂ ਮਨ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ ਨਿਯਮਿਤ ਯੋਗ ਅਤੇ ਧਿਆਨ ਮਨ ਨੂੰ ਸ਼ਾਂਤੀ ਦਿੰਦੇ ਹਨ ਅਤੇ ਕੋਟੀਸੋਲ ਜਿਵੇਂ ਤਨਾਅ ਦੇ ਹਾਰਮੋਨ ਨੂੰ ਘਟਾਉਂਦੇ ਹਨ ਯੋਗ ਦੇ ਅਭਿਆਸ ਨਾਲ ਧਿਆਨ ਕੇਂਦਰਤਾ ਅਤੇ ਯਾਦਾਸ਼ਤ ਵੱਧਦੀ ਹੈ ਜੋ ਵਿਦਿਆਰਥੀਆਂ ਅਤੇ ਅਤੇ ਕੰਮਕਾਜੀ ਕੰਮਕਾਜੀ ਲੋਕਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ ਆਤਮ ਨਿਯੰਤਰਨ ਨੂੰ ਵਿਕਸਿਤ ਕਰਦਾ ਹੈ ਯੋਗ ਮਨੁੱਖ ਨੂੰ ਆਤਮ ਅਨੁਸ਼ਾਸਨ ਅਤੇ ਸੰਤੁਲਨ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਉਹ ਹੋਰ ਆਤਮ ਉੱਨਤੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਸਕਦੇ ਹਨ ਯੋਗ ਸਾਨੂੰ ਸਿਰਫ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨਹੀਂ ਦਿੰਦਾ ਸਗੋਂ ਇਹ ਆਤਮਿਕ ਤੌਰ 'ਤੇ ਵੀ ਇੱਕ ਨਵੀਂ ਉਚਾਈ 'ਤੇ ਪਹੁੰਚਾਉਂਦਾ ਹੈ ਮਨੁੱਖ ਨੂੰ ਆਤਮ ਗਿਆਨ ਪ੍ਰਾਪਤ ਹੋਣ ਵਿੱਚ ਮਦਦ ਕਰਦਾ ਹੈ ਮਨੁੱਖ ਵਿੱਚ ਸ਼ਾਂਤੀ ਸੰਤੁਲਨ ਅਤੇ ਆਤਮਿਕ ਜਾਗਰੂਕਤਾ ਪੈਦਾ ਹੁੰਦੀ ਹੈ ਯੋਗ ਦੁਆਰਾ ਮਨੁੱਖ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਸਮਝਣ ਲੱਗਦਾ ਹੈ ਅਤੇ ਉਹ ਆਪਣੇ ਆਤਮਿਕ ਵਿਕਾਸ ਦੀ ਦਿਸ਼ਾ ਨੂੰ ਦਿਸ਼ਾ ਵਿੱਚ ਤਰੱਕੀ ਕਰਦਾ ਹੈ ਅੱਜ ਦੀ ਤਨਾਅ ਭਰੀ ਜ਼ਿੰਦਗੀ ਵਿੱਚ ਯੋਗ ਇੱਕ ਆਸ਼ ਆਵਸ਼ਕ ਹਿੱਸਾ ਬਣ ਚੁੱਕਾ ਹੈ ਜੋ ਸਾਨੂੰ ਸਰੀਰਕ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਦਿੰਦਾ ਹੈ ਇਹ ਸਾਡੇ ਜੀਵਨ ਦੀ ਜੀਵਨ ਸ਼ੈਲੀ ਨੂੰ ਸੁਧਾਰਨ ਤਨਾਅ ਘਟਾਉਣ ਰੋਗ ਪ੍ਰਤੀ ਰੋਧਕ ਸ਼ਕਤੀ ਵਧਾਉਣ ਅਤੇ ਦਿਲ ਦੀ ਤੰਦਰੁਸਤੀ ਨੂੰ ਸੰਭਾਲਣ ਵਿੱਚ ਮਦਦ ਕਰਦਾ ਹੈ ਇਸ ਲਈ ਹਰ ਵਿਅਕਤੀ ਨੂੰ ਰੋਜ਼ਾਨਾ ਕਮ ਤੋਂ ਕਮ ਤੀਹ ਤੋਂ ਪੰਤਾਲੀ ਮਿੰਟ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਸੁਖੀ ਅਤੇ ਆਤਮਿਕ ਤੌਰ 'ਤੇ ਸਮਰਥ ਜੀਵਨ ਬਤੀਤ ਕਰ ਸਕੇ